ਮੈਂ ਨਾ ਰੈੱਡਮੀਂ ਦਾ ਫ਼ੋਨ ਲੀਤਾ ਸੀ ਮੈਨੂੰ ਇਹ ਬਿਲਕੁਲ ਪਸੰਦ ਨਹੀਂ ਆਇਆ ਇਸਦੀ ਕੁਆਲਟੀ ਬਹੁਤ ਹੀ ਜ਼ਿਆਦਾ ਘਟੀਆ ਹੈ ਇਸ ਦਾ ਸਾਰਾ ਬਿਲਡ ਬਹੁਤ ਬੇਕਾਰ ਹੈ ਅਤੇ ਇਸ ਵਿੱਚ ਅਵਾਜ਼ ਵੀ ਫਟ ਫਟ ਕੇ ਆਉਂਦੀ ਹੈ ਨਾਲ ਦੀ ਨਾਲ ਇਸਦਾ ਕੈਮਰਾ ਬਹੁਤ ਹੀ ਜ਼ਿਆਦਾ ਬੇਕਾਰ ਚੱਲਦਾ ਹੈ ਅਤੇ ਜੇ ਕੋਈ ਜ਼ਿਆਦਾ ਬੜੀ ਐਪਲੀਕੇਸ਼ਨ ਇਸ ਵਿੱਚ ਪਾ ਲੀਤੀ ਜਾਵੇ ਤਾਂ ਆਹ ਗਰਮ ਹੋ ਜਾਂਦਾ ਹੈ ਅਤੇ ਬੰਦ ਹੋ ਜਾਂਦਾ ਹੈ ਇਹ ਅਮ ਐਨਾ ਘ ਐਨਾ ਘਟੀਆ ਫ਼ੋਨ ਮੈਂ ਅਜੇ ਤੱਕ ਨਹੀਂ ਦੇਖਿਆ ਅਤੇ ਇਸਦਾ ਰੇਟ ਵੀ ਮੈਨੂੰ ਉਹਨਾਂ ਨੇ ਬਹੁਤ ਜ਼ਿਆਦਾ ਲਾ ਦਿੱਤਾ